ਵਧੇਰੇ ਪੈਸੇ ਬਚਾਉਣ ਲਈ ਸਾਨੂੰ ਪੈਸੇ ਨੂੰ ਇਨਵੈਸਟ ਕਰਨਾ ਚਾਹੀਦਾ ਹੈ ਅਗਰ ਆਪਾਂ ਅਸੀਂ ਦਿਨ ਦਾ ਸੌ ਰੁਪਈਆ ਕਮਾ ਰਹੇ ਹਾਂ ਉਨ੍ਹਾਂ ਸੌ ਰੁਪਈਆਂ ਦੇ ਵਿੱਚੋਂ ਸਾਨੂੰ ਆਪਣੇ ਦਸ ਰੁਪਈਏ ਸ਼ੇਅਰ ਬਜ਼ਾਰ ਵਿੱਚ ਲਗਾਉਣੇ ਚਾਹੀਦੇ ਹਨ ਅਗਰ ਸ਼ੇਅਰ ਬਜ਼ਾਰ ਵਿੱਚ ਅਸੀਂ ਅੱਜ ਦੇ ਟਾਈਮ ਦਸ ਰੁਪਈਏ ਲਗਾ ਰਹੇ ਹਾਂ ਸਾਲ ਬਾਅਦ ਉਹ ਹੀ ਸ਼ੇਅਰ ਦਾ ਭਾਅ ਇੱਕ ਸੌ ਦਸ ਰੁਪਏ ਹੋਊਗਾ ਦੇਖੋ ਕਿੰਨੀ ਇੰਪਰੂਵਮੈਂਟ ਆਈ ਦਸ ਤੋਂ ਇੱਕ ਸੌ ਦਸ ਹੋ ਗਿਆ ਉਹ ਸਾਲ ਦੇ ਵਿੱਚ ਇੱਕ ਸੌ ਦਸ ਹੋ ਗਿਆ ਇੰਨੀ ਜ਼ਿਆਦਾ ਇੰਪਰੂਵਮੈਂਟ ਆਈ ਇਸ ਦੇ ਨਾਲ ਅਸੀਂ ਪੈਸੇ ਬਣਾ ਵੀ ਸਕਦੇ ਹੈ ਪੈਸਿਆਂ ਨੂੰ ਸੇਵ ਵੀ ਕਰ ਸਕਦੇ ਹੈਗੇ ਸ਼ੇਅਰ ਬਜ਼ਾਰ ਦੇ ਵਿੱਚ ਠੀਕ ਹੈ ਨੈੱਟ 'ਤੇ ਅਮਿਤ ਜੈਨ ਹੈ ਜਿਸ ਨੂੰ ਮੈਂ ਫੋਲੋ ਕਰਦਾ ਉਨ੍ਹਾਂ ਦੀ ਕਹੀ ਹਰ ਇੱਕ ਗੱਲ ਨੂੰ ਮੈਂ ਹਮੇਸ਼ਾ ਲਾਈਕ ਕਰਦਾ ਹਾਂ ਉਹ ਹਮੇਸ਼ਾ ਸਾਨੂੰ ਦੱਸਦੇ ਨੇ ਵੀ ਪੈਸੇ ਇਨਵੈਸਟ ਕਰਨ ਦੇ ਕਿਹੜੇ ਕਿਹੜੇ ਸਾਧਨ ਉਨ੍ਹਾਂ ਵਿੱਚ ਇੱਕ ਸਾਧਨ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਆਪਾਂ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰਨੇ ਚਾਹੀਦੇ ਹਨ ਆਪਣੀ ਕੁਛ ਕੁ ਪਰਸਨਲ ਸੇਵਿੰਗ ਵੀ ਰੱਖਣੀ ਚਾਹੀਦੀ ਹੈ ਅਤੇ ਕੁਛ ਪੈਸੇ ਆਪਾਂ ਨੂੰ ਇਨਵੈਸਟ ਅਗਰ ਆਪਾਂ ਚੰਗੀ ਜਗ੍ਹਾ ਪੈਸਾ ਇਨਵੈਸਟ ਕਰਦੇ ਹਾਂ ਤਾਂ ਉਸਦਾ ਭਾਅ ਇਹ ਨਹੀਂ ਪਤਾ ਦੁੱਗਣਾ ਤਿੱਗਣਾ ਚੋਗਣਾ ਹੋ ਜਾਵੇ ਸਾਲ ਬਾਅਦ ਠੀਕ ਹੈ ਇਸ ਨਾਲ ਨਾ ਤਾਂ ਪੈਸਾ ਇਨਵੈਸਟ ਹੁੰਦਾ ਨਾਲ ਹੀ ਪੈਸੇ ਦੀ ਕੀ ਹੋ ਜਾਂਦੀ ਹੈ ਬੱਚਤ ਹੋ ਜਾਂਦੀ ਹੈ ਅਗਰ ਦਿਨ ਦੇ ਵਿੱਚ ਕੋਈ ਪਰਸਨ ਦੋ ਸੌ ਰੁਪਇਆ ਕਮਾ ਰਿਹਾ ਦੋ ਸੌ ਰੁਪਈਏ ਦੇ ਵਿੱਚ ਅਗਰ ਉਹ ਪੰਜਾਹ ਪੈਸੇ ਪੰਜਾਹ ਰੁਪਈਏ ਵੀ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਦਾ ਹੈ ਉਸ ਨੂੰ ਉਸਦਾ ਬਹੁਤ ਜ਼ਿਆਦਾ ਲਾਭ ਮਿਲਦਾ ਹੈਗਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਅਮਿਤ ਜੈਨ ਨੂੰ ਡੇਲੀ ਫੋਲੋ ਕਰਦਾ ਉਨ੍ਹਾਂ ਦੀ ਡੇਲੀ ਯੂਟਿਊਬ 'ਤੇ ਵੀਡੀਓਜ਼ ਦੇਖਦਾ ਹੈਗਾ ਉਨ੍ਹਾਂ ਵਿੱਚ ਇੱਕ ਤੁਹਾਨੂੰ ਮੈਂ ਦੱਸ ਹੀ ਚੁੱਕਿਆਂ ਵੀ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਨੂੰ ਇਨਵੈਸਟ ਕਰਨਾ ਪੈਸਾ ਐਵੇਂ ਇਨਵੈਸਟ ਨਹੀਂ ਹੁੰਦਾ ਵੀ ਜਿਵੇਂ ਆਪਾਂ ਕਹਿ ਦੇਈਏ ਵੀ ਚਲੋ ਪੰਜਾਹ ਰੁਪਈਏ ਕੀ ਕਰਦੇ ਨੇਗੇ ਆਪਾਂ ਬੈਂਕ ਦੇ ਖਾਤੇ 'ਚ ਜਮ੍ਹਾਂ ਕਰਵਾ ਆਉਂਦੇ ਨਹੀਂ ਸ਼ੇਅਰ ਮਾਰਕੀਟ ਮੈਂ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਵੀ ਅਗਰ ਆਪਾਂ ਸ਼ੇਅਰ ਮਾਰਕੀਟ 'ਚ ਪੈਸੇ ਇਨਵੈਸਟ ਕਰ ਰਹੇ ਹੈ ਸਾਲ ਬਾਅਦ ਉਹ ਹੀ ਪੰਜਾਹ ਰੁਪਈਏ ਆਪਣੇ ਅਗਰ ਡੇਢ ਸੌ ਰੁਪਈਏ ਦੇ ਵਿੱਚ ਬਦਲ ਦੇਣੇ ਤਾਂ ਦੇਖੋ ਕਿੰਨਾ ਤਾਂ ਇੰਪਰੂਵਮੈਂਟ ਹੋਈ ਹੈ ਅਤੇ ਕਿੰਨੇ ਪੈਸੇ ਦੀ ਸੇਵਿੰਗ ਹੋਈ ਹੈ ਇੱਕ ਤਾਂ ਆਪਣਾ ਪੈਸਾ ਇਨਵੈਸਟ ਵੀ ਹੁੰਦਾ ਇੱਕ ਪੈਸਾ ਸੇਵ ਵੀ ਹੁੰਦਾ ਸ਼ੇਅਰ ਮਾਰਕੀਟ ਦੇ ਵਿੱਚ ਇਹ ਸਾਰਾ ਕੁਝ ਮੈਨੂੰ ਪ੍ਰੇਰਨਾ ਅਮਿਤ ਜੈਨ ਤੋਂ ਮਿਲੀ ਹੈ ਯੂਟਿਊਬ 'ਤੇ ਅਮਿਤ ਜੈਨ ਦੀ ਵੀਡੀਓ ਹੈਗੀ ਹੈ ਉਨ੍ਹਾਂ ਨੇ ਬਹੁਤ ਚੰਗੇ ਢੰਗ ਨਾਲ ਇਸਨੂੰ ਬਿਆਨ ਕੀਤਾ ਅਗਰ ਇਸ ਬਾਰੇ ਕੋਈ ਹੋਰ ਸਲਾਹ ਲੈਣਾ ਚਾਹੁੰਦਾ ਤਾਂ ਉੱਥੋਂ ਉੱਥੋਂ ਜਾ ਕੇ ਉਨ੍ਹਾਂ ਦੀ ਵੀਡੀਓ ਦੇਖੇ ਸ਼ੋਸ਼ਲ ਮੀਡੀਆ 'ਤੇ ਵੀ ਬਹੁਤ ਜ਼ਿਆਦਾ ਵੀਡੀਓਜ਼ ਅਪਲੋਡ ਹੁੰਦੀਆਂ ਨੇਗੀਆਂ ਵੀ ਬੈਂਕ ਖਾਤੇ ਦੇ ਵਿੱਚ ਸਟੋਰ ਰੱਖੋ ਉਹ ਵੀ ਬਹੁਤ ਵਧੀਆ ਸੇਵਿੰਗ ਹੈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਵਧੀਆ ਸੇਵਿੰਗ ਨਹੀਂ ਹੈਗੀ ਵੀ ਆਪਾਂ ਆਪਣੇ ਨਾਮ 'ਤੇ ਐੱਫ ਡੀ ਕਰਵਾ ਲੈਂਦੇ ਹਾਂ ਅਗਰ ਆਪਾਂ ਅੱਜ ਦੇ ਟਾਈਮ ਨੂੰ ਐੱਫ ਡੀ ਟੈੱਨ ਥਾਉਜੈਂਟ ਰੁਪੀਜ ਦੀ ਕਰਵਾਉਂਦੇ ਹੈ ਤਾਂ ਆਪਣੀ ਉਹ ਹੀ ਚਾਰ ਪੰਜ ਸਾਲਾਂ ਬਾਅਦ ਉਹ ਹੀ ਦੇਖੋ ਕਿੱਥੇ ਤੱਕ ਪਹੁੰਚ ਜੂਗੀ ਐੱਫ ਡੀ ਠੀਕ ਹੈ ਨੋ ਡਾਊਟ ਵਧੀਆ ਚੀਜ਼ ਹੈ ਪਰ ਸ਼ੇਅਰ ਮਾਰਕੀਟ ਵੀ ਬਹੁਤ ਵਧੀਆ ਇਨਵੈਸਟਿੰਗ ਇੱਕ ਆਪਾਂ ਕਹਿ ਦੇਈਏ ਸੰਸਥਾ ਕਹਿ ਦਿਓ ਪਲੇਸ ਕਹਿ ਦਿਓ ਵੀ ਬਹੁਤ ਵਧੀਆ ਹੈਗੀ ਆ ਅਗਰ ਕਿਸੇ ਨੇ ਪੈਸਾ ਇਨਵੈਸਟ ਕਰਨਾ ਹੈ ਤਾਂ ਸ਼ੇਅਰ ਮਾਰਕੀਟ ਉਸ ਲਈ ਬਹੁਤ ਜ਼ਿਆਦਾ ਵਧੀਆ ਹੈਗਾ ਠੀਕ ਹੈ ਅਗਰ ਇਸ ਬਾਰੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਅਮਿਤ ਜੈਨ ਫਾਇਨੈਂਸ਼ੀਅਲ ਮੈਨੇਜਮੈਂਟ ਭਰ ਲਓ ਜਾਂ ਫਾਈਨੈਂਸ਼ੀਅਲ ਕੀ ਕਹਿੰਦੇ ਨੇਗੇ ਸਲਾਹਕਾਰ ਆਪਾਂ ਕਹਿ ਦਿੰਦੇ ਨੇਗੇ ਕੋਈ ਹੁੰਦਾ ਹੈਗਾ ਉਹਦੇ ਬਾਰੇ ਭਰ ਲਓ ਉੱਥੇ ਤੁਹਾਨੂੰ ਉਹਦੀ ਵੀਡੀਓ ਮਿਲਜੂਗੀ ਅਗਰ ਤੁਸੀਂ ਪ੍ਰੋਪਰ ਵੇਅ ਨਾਲ ਉਸਦੀ ਵੀਡੀਓ ਸੁਣੋਗੇ ਤਾਂ ਤੁਹਾਨੂੰ ਸੱਚਮੁੱਚ ਦੇ ਵਿੱਚ ਇਹ ਗੱਲ ਪ੍ਰਤੀਤ ਹੋਊਗੀ ਵੀ ਜੋ ਮੈਂ ਗੱਲ ਕਹਿ ਰਿਹਾ ਵੀ ਸ਼ੇਅਰ ਮਾਰਕੀਟ 'ਚ ਅਸਲੀ ਪੈਸਾ ਇਨਵੈਸਟ ਕਰਨ ਨਾਲ ਨਾਲੇ ਤਾਂ ਸਾਡੇ ਪੈਸੇ ਦੀ ਬੱਚਤ ਹੁੰਦੀ ਹੈ ਨਾਲੇ ਇਨਵੈਸਟ ਹੁੰਦੇ ਹੈ ਅਗਰ ਮੈਂ ਇੱਕ ਸਲਾਹ ਤੁਹਾਨੂੰ ਹੋਰ ਦੇਵਾਂ ਅੱਜ ਕੱਲ੍ਹ ਪ੍ਰੋਪਰਟੀ ਡੀਲਰਸ 'ਤੇ ਵੀ ਬਹੁਤ ਕੁਝ ਸਕੀਮਸ ਆਉਂਦੀਆਂ ਨੇ ਜਿਵੇਂ ਕੁਝ ਐਗਜਾਂਪਲ ਮੈਂ ਤੁਹਾਨੂੰ ਦੇ ਸਕਦਾ ਹਾਂ ਕਾਫ਼ੀ ਪ੍ਰੋਪਰਟੀ ਡੀਲਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਹਰੇਕ ਸਾਲ ਇੱਕ ਇੱਕ ਲੱਖ ਰੁਪਈਆ ਦੇਣਾ ਹੁੰਦਾ ਗਾ ਠੀਕ ਹੈ ਦਸ ਸਾਲ ਦੇ ਵਿੱਚ ਆਪਾਂ ਨੇ ਉਨ੍ਹਾਂ ਨੂੰ ਹਰ ਇੱਕ ਸਾਲ ਲੱਖ ਲੱਖ ਰੁਪਈਆ ਦੇਣਾ ਹੁੰਦਾ ਹੈ ਦਸ ਸਾਲ ਬਾਅਦ ਆਪਣਾ ਉਨ੍ਹਾਂ ਕੋਲ ਦਸ ਲੱਖ ਰੁਪਈਆ ਚਲਾ ਜਾਂਦਾ ਦਸ ਲੱਖ ਜਾਣ ਤੋਂ ਬਾਅਦ ਆਪਣਾ ਇੱਕ ਕੀ ਕਹਿੰਦੇ ਨੇ ਉਹ ਆਪਾਂ ਨੂੰ ਕੀ ਦੇ ਜਾਂਦੇ ਨੇ ਘਰ ਦੇ ਜਾਂਦੇ ਨੇ ਬਹੁਤ ਵਧੀਆ ਏਰੀਆ ਦੇ ਵਿੱਚ ਉਸ ਘਰ ਦੀ ਇੰਨੀ ਜ਼ਿਆਦਾ ਕੀਮਤ ਹੁੰਦੀ ਹੈ ਉਸ ਜਗ੍ਹਾ ਦੇ ਵਿੱਚ ਐਂ ਮੰਨ ਕੇ ਚੱਲੋ ਤੀਹ ਲੱਖ ਉਸ ਜਗ੍ਹਾ ਦੇ ਵਿੱਚ ਉਸਦੀ ਕੀਮਤ ਹੁੰਦੀ ਦੇਖੋ ਪੈਸਾ ਇੱਕ ਜਗ੍ਹਾ ਤਾਂ ਇਨਵੈਸਟ ਹੋਇਆ ਇੱਕ ਜਗ੍ਹਾ ਕੀ ਹੋਇਆ ਬੱਚਤ ਵੀ ਹੋਈ ਠੀਕ ਹੈ ਇਸ ਢੰਗ ਨਾਲ ਅਗਰ ਆਪਾਂ ਪ੍ਰੋਪਰਟੀ ਡੀਲਰ 'ਚ ਇਨਵੈਸਟ ਕਰਾਂਗੇ ਉਹ ਵੀ ਬਹੁਤ ਵਧੀਆ ਢੰਗ ਹੈ ਸ਼ੇਅਰ ਮਾਰਕੀਟ 'ਚ ਪੈਸਾ ਇਨਵੈਸਟ ਕਰਾਂਗੇ ਉਹ ਵੀ ਬਹੁਤ ਵਧੀਆ ਢੰਗ ਹੈ ਆਪਾਂ ਆਪਣੇ ਕੋਲ ਸੇਵਿੰਗ ਤਾਂ ਦੇਖੋ ਕਰ ਨਹੀਂ ਸਕਦੇ ਹੈਗੇ ਕਿਉਂਕਿ ਕਦੇ ਨਾ ਕਦੇ ਆਪਾਂ ਪੈਸੇ ਮਿੰਟ 'ਚ ਪੈਸਾ ਲਗਾ ਆਉਂਦੇ ਹਾਂ ਅਗਰ ਆਪਾਂ ਐੱਫ ਡੀ ਕਰਵਾ ਕੇ ਰੱਖਾਂਗੇ ਉਹ ਵੀ ਵਧੀਆ ਬਹੁਤ ਵਧੀਆ ਚੀਜ਼ ਹੈ ਅੱਜ ਕੱਲ੍ਹ ਇੰਟਰਨੈੱਟ ਦੇ ਮਾਧਿਅਮ ਵੀ ਬਹੁਤ ਚੱਲੇ ਪਏ ਹਨ ਵੀ ਕੀ ਕਹਿੰਦੇ ਨੇ ਆਪਾਂ ਨੇ ਅਗਰ ਪੈਸੇ ਦੀ ਸੇਵਿੰਗ ਕਰਨੀ ਹੈ ਬੱਚਤ ਕਰਨੀ ਇਨਵੈਸਟ ਕਰਨਾ ਉਹ ਵੀ ਬਹੁਤ ਵਧੀਆ ਸਾਧਨ ਹੈ ਪਰ ਮੈਂ ਆਪਣਾ ਤੁਹਾਨੂੰ ਦੱਸਿਆ ਹੈ ਵੀ ਮੈਂ ਅਮਿਤ ਜੈਨ ਨੂੰ ਫੋਲੋ ਕਰਦਾ ਹਾਂ ਉਨ੍ਹਾਂ ਦੀ ਹਰ ਗੱਲ ਕਹੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਥੈਂਕਿ ਊ ਸੋ ਮੱਚ